ਕੁਦਰਤੀ ਸਰੋਤ ਉਹ ਹਨ ਜਿਹੜੇ ਸਾਨੂੰ ਕੁਦਰਤ ਤੋਂ ਆਉਂਦੇ ਹਨ ਜਿਵੇਂ ਕਿ ਨਹਿਰਾਂ ਨਦੀਆਂ ਤਲਾਬ ਆਦਿ ਸਾਡੇ ਖੇਤਰ ਵਿੱਚ ਜਿਵੇਂ ਕਹਿ ਸਕਦੇ ਹਾਂ ਕਿ ਪਾਣੀ ਵਿੱਚ ਜੰਗ ਪਾਣੀ ਤੋਂ ਜੰਗਲ ਜਿਵੇਂ ਕਿ ਪਾਣੀ ਦੇ ਨਾਲ ਬਿਜਲੀ ਪੈਦਾ ਕੀਤੀ ਜਾਂਦੀ ਹੈ ਕਿ ਵੱਖ ਵੱਖ ਖੇਤਰਾਂ ਵਿੱਚ ਜੰਗਲ ਆਦਿ ਦੀ ਜੜ੍ਹੀ ਬੂਟੀਆਂ ਦਵਾਈਆਂ ਤਿਆਰ ਕੀਤੀਆਂ ਜਾਂਦੀਆਂ ਨੇ ਇਹਨਾਂ ਤੋਂ ਸਾਨੂੰ ਕੁਦਰਤੀ ਸਰੋਤਾਂ ਤੋਂ ਆਕਸੀਜਨ ਜਿਵੇਂ ਹੋਰ ਕਈ ਪ੍ਰਕਾਰ ਦੀਆਂ ਗੈਸਾਂ ਮਿਲਦੀਆਂ ਹਨ ਅਤੇ ਕੁਦਰਤੀ ਸਰੋਤ ਨਹਿਰਾਂ ਤੋਂ ਪਾਣੀ ਵੱਖ ਵੱਖ ਖੇਤਰਾਂ ਵਿੱਚ ਭੇਜਿਆ ਜਾ ਭੇਜਿਆ ਜਾਂਦਾ ਹੈ